ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਕਰਿਆਨੇ ਦੀਆਂ ਦੁਕਾਨਾਂ ਹਨ ਉੱਥੇ ਬਹੁਤ ਸਾਰੀਆਂ ਚੀਜ਼ਾਂ ਉਪਲੱਬਧ ਹਨ ਜਿਵੇਂ ਕਿ ਸੁੱਕੀਆਂ ਦਾਲਾਂ ਸੁੱਕੀਆਂ ਦਾਲਾਂ ਚੀਨੀ ਸ਼ੱਕਰ ਗੁੜ ਅਤੇ ਸਾਰੇ ਤਰ੍ਹਾਂ ਦੇ ਮਸਾਲੇ ਵੀ ਪਾਏ ਜਾਂਦੇ ਹਨ ਇਸ ਦੇ ਨਾਲ ਨਾਲ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਵੀ ਹੁੰਦਾ ਹੈ ਜਿਵੇਂ ਕਿ ਟੋਫੀਆਂ ਚੋਕਲੇਟਸ ਅਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਦੁਕਾਨਦਾਰ ਆਪਣੀ ਆਪਣੀ ਦੁਕਾਨ 'ਤੇ ਰੱਖਦੇ ਹਨ ਤਾਂ ਕਿ ਪਿੰਡ ਦੇ ਲੋਕਾਂ ਨੂੰ ਬਾਹਰ ਬਾਜ਼ਾਰ ਵਿੱਚ ਦੂਰ ਜਾਣ ਦੀ ਜ਼ਰੂਰਤ ਨਾ ਪਵੇ ਅਸੀਂ ਆਪਣੀ ਦੁਕਾਨਦਾਰ ਦੇ ਨਾਲ ਕਈ ਵਾਰ ਸੌਦੇਬਾਜ਼ੀ ਵੀ ਕਰਦੇ ਹਾਂ ਜਾਂ ਜੇ ਸਮੇਂ ਸਿਰ ਪੈਸੇ ਹੁੰਦੇ ਹਨ ਤਾਂ ਅਸੀਂ ਸਮੇਂ 'ਤੇ ਭੁਗਤਾਨ ਕਰ ਦਿੰਦੇ ਹਾਂ ਪਰ ਸਮ ਅਸੀਂ ਭੁਗਤਾਨ ਕਰਦੇ ਜ਼ਰੂਰ ਹਾਂ ਕਿਉਂਕਿ ਅਸੀਂ ਉਸ ਦੁਕਾਨ ਤੋਂ ਜ਼ਿਆਦਾਤਰ ਸਮਾਨ ਲੈਂਦੇ ਰਹਿੰਦੇ ਹਾਂ ਪਿੰਡ ਦੇ ਵਿੱਚ ਲੋਕ ਆਪਣੇ ਨਾਲ ਦੀਆਂ ਦੁਕਾਨਾਂ ਤੋਂ ਬਿਨਾਂ ਪੈਸੇ ਦਿੱਤੇ ਇੱਕ ਟਾਈਮ 'ਤੇ ਸਮਾਨ ਲੈ ਲੈਂਦੇ ਹਨ ਅਤੇ ਬਾਅਦ ਦੇ ਵਿੱਚ ਭੁਗਤਾਨ ਕਰ ਦਿੰਦੇ ਹਨ